ਖ਼ਾਸ ਕਰ ਪਿੰਡਾਂ ਜਾਂ ਸ਼ਹਿਰਾਂ ਵਿੱਚ ਨਜ ਨਜ਼ਦੀਕੀ ਮਾਰਕੀਟ ਵਿੱਚ ਪਹੁੰਚਣਾ ਕੋਈ ਘਰ ਲਈ ਕੁਛ ਸਮਾਨ ਸੌਦਾ ਲਿਆਉਣਾ ਅਤੇ ਸਕੂਲ ਕਾਲਜ ਜਾਣਾ ਪੁਲਿਸ ਦੇ ਡਰ ਤੋਂ ਬਚਣਾ ਪੂਰੀ ਸੇਫਟੀ ਨਾਲ ਜਾਣਾ ਟਰੈਫਿਕ ਸਮੱਸਿਆ ਤੋਂ ਮੇਨਲੀ ਜ਼ਿਆਦਾਤਰ ਬਚਣ ਲਈ ਸਕੂਲ ਜਾਂ ਕਾਲਜ ਜਾਣ ਲਈ ਵਰਤੋਂ ਕੀਤੀ ਜਾਂਦੀ ਹੈ ਅਤੇ ਸੂਬਹਾ ਦੀ ਸੈਰ ਲਈ ਜੇਕਰ ਪਾਰਕ ਜਾਂ ਖੇਤ ਤੁਹਾਡੇ ਘਰ ਤੋਂ ਥੋੜ੍ਹਾ ਦੂਰ ਹੈ ਸਾਈਕਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਕਿ ਉੱਥੇ ਬਿਨ੍ਹਾਂ ਕਿਸੇ ਦਿੱਕਤ ਤੋਂ ਉੱਥੇ ਪਹੁੰਚਿਆ ਜਾਵੇ ਅਤੇ ਦਫ਼ਤਰ ਜਾ ਹੋਰ ਕ ਕਈ ਜਗਾਵਾ 'ਤੇ ਪਹੁੰਚਣ ਲਈ ਸਾਈਕਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਉਹਨਾਂ ਦੇ ਨਾਲ ਨਾਲ ਹੋਰ ਕਈ ਜ ਜਗਾਵਾਂ ਸਥਾਵਾਂ ਜਿਵੇਂ ਗੁਰਦੁਆਰੇ ਜਾਂ ਫਿਰ ਧਾਰਮਿਕ ਥਾਵਾਂ 'ਤੇ ਪਹੁੰਚਿਆ ਜਾ ਸਕਦਾ ਸਾਈਕਲ ਨਾਲ ਸਾਇਕਲ ਦੀ ਸਾਦਗੀ ਜਿੱਦਾਂ ਕਿ ਕੋਈ ਜਿੱਦਾਂ ਕਿ ਵਾਤਾਵਰਨ ਨੂੰ ਗੰਦਾ ਨਹੀਂ ਕਰਦਾ ਸਾਈਕਲ ਵਾਤਾਵਰਨ ਨੂੰ ਸਾਫ਼ ਰੱਖਦਾ ਆਏ ਸਿਫਾਰਸ਼ਾਂ ਸਾਈਕਲ ਦੀਆਂ ਇਹ ਹਨ ਕਿ ਸ ਸਾਈਕਲ ਚਲਾਉਂਦੇ ਵੇਲੇ ਸੇਫਟੀ ਗੇਅਰ ਪਾ ਕੇ ਰੱਖੋ ਜਿਵੇਂ ਕਿ ਹੈਲਮੈਟ ਹੋ ਗਿਆ ਹੈਡ ਲਾਈਟ ਹੋਣੀ ਚਾਹੀਦੀ ਹੈ ਸਾਈਕਲ ਦੀ ਸਾਈਕਲ ਦੀ ਸਹੀ ਦੇਖ ਭਾਲ ਕਰੋ ਤਾਂ ਕਿ ਰਸਤੇ ਵਿੱਚ ਸਾਨੂੰ ਕੋਈ ਸਮੱਸਿਆ ਨਾ ਆਵੇ